ਮੈਂ ਰੇਲ ਯਾਤਰਾ ਰਾਹੀਂ ਅਯੋਧਿਆ ਵਿਖੇ ਜਾਣਾ ਚਾਹੁੰਦੀ ਹਾਂ ਮੇਰਾ ਸੁਪਨਾ ਹੈ ਕਿ ਮੈਂ ਅਯੋਧਿਆ ਦਾ ਮੰਦਰ ਵੇਖ ਕੇ ਆਵਾਂ ਇਸ ਦੇ ਲਈ ਮੈਨੂੰ ਵੰਦੇ ਭਾਰਤ ਦੀਆਂ ਟਿਕਟਾਂ ਚਾਹੀਦੀਆਂ ਹਨ ਪਰ ਮੈਨੂੰ ਇਹ ਟਿਕਟਾਂ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ ਹਨ ਮੈਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਸਮੇਂ ਸਿਰ ਮੇਰੀ ਪਸੰਦੀਦਾ ਫਸਟ ਕਲਾਸ ਦੀਆਂ ਸੀਟਾਂ ਮਿਲ ਜਾਣ ਅਤੇ ਮੈਨੂੰ ਇਹ ਸਬੰਧੀ ਮਾਰਗਦਰਸ਼ਨ ਵੀ ਪ੍ਰਾਪਤ ਹੋ ਜਾਵੇ

ਮੈਂ ਚਾਹੁੰਦੀ ਹਾਂ ਕਿ ਮੈਨੂੰ ਸਮੇਂ ਸਿਰ ਸਾਰੀਆਂ ਟਿਕਟਾਂ ਮਿਲ ਜਾਣ ਤਾਂ ਜੋ ਮੈਂ ਆਪਣੀ ਯਾਤਰਾ ਨੂੰ ਸਫ਼ਲ ਕਰ ਸਕਾਂ